ਬੈਂਕਿੰਗ ਸੈਕਟਰ ਦਾ ਦੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਭੂਮਿਕਾ ਹੈ ਬੈਂਕਾਂ ਦੇ ਨਾਲ ਜੁੜਨ ਕਰਕੇ ਸਾਡੇ ਜਿਹੜੇ ਲੋਕਾਂ ਦਾ ਜਿਹੜਾ ਪੈਸਾ ਹੈ ਉਹ ਉਹਨੂੰ ਕਾਫੀ ਹੱਦ ਤੱਕ ਸੇਫ ਰੱਖਿਆ ਜਾ ਸਕਦਾ ਇਸ ਤੋਂ ਇਲਾਵਾ ਬੈਂਕਾਂ ਦੇ ਏਟੀਐਮਾਂ ਤੋਂ ਸਾਨੂੰ ਜਿਹੜੇ ਪੈਸੇ ਦਾ ਲੈਣ ਦੇਣ ਹੋਰ ਵੀ ਸੌਖਾ ਹੋ ਗਿਆ ਕਿਉਂਕਿ ਇੱਕ ਏ ਟੀ ਐਮ ਦੇ ਥਰੂ ਅਸੀਂ ਪੈਸੇ ਜਮਾਂ ਵੀ ਕਰਵਾ ਸਕਦੇ ਹਾਂ ਅਤੇ ਪੈਸੇ ਕਢਵਾ ਵੀ ਸਕਦੇ ਹਾਂ ਇਸ ਦੇ ਨਾਲ ਹੀ ਅਸੀਂ ਜੇ ਕੋਈ ਦੂਰ ਦੁਰਾਡੇ ਸਾਡਾ ਕੋਈ ਸੱਜਣ ਮਿੱਤਰ ਬੈਠਾ ਹੈ ਉਹ ਦੂਸਰੇ ਸ਼ਹਿਰ ਦੇ ਵਿੱਚ ਬੈਠਾ ਜਾਂ ਦੂਸਰੇ ਉਸ ਦੇ ਵਿੱਚ ਬੈਠਾ ਤਾਂ ਸਾਨੂੰ ਉਹਨੂੰ ਪੈਸੇ ਭੇਜਣ ਦੇ ਵਿੱਚ ਵੀ ਕਾਫੀ ਸਹਾਇਤਾ ਮਿਲਦੀ ਹੈ ਕਿਉਂਕਿ ਏ ਟੀ ਐੱਮ ਦੇ ਥਰੂ ਅਸੀਂ ਪੈਸੇ ਜਮਾਂ ਕਰਾ ਸਕਦੇ ਹਾਂ ਅਤੇ ਪੈਸੇ ਕਢਵਾ ਸਕਦੇ ਹਾਂ ਇਸ ਦੇ ਨਾਲ ਹੀ ਅਸੀਂ ਪੈਸੇ ਜੇ ਕਿਸੇ ਨੂੰ ਭੇਜਣੇ ਤਾਂ ਉਹ ਵੀ ਭੇਜੇ ਜਾ ਸਕਦੇ ਆ ਆਪਣੇ ਉਸ ਤੋਂ ਇਲਾਵਾ ਜਿਹੜਾ ਬੀਮਾ ਹੈ ਬੀਮੇ ਦਾ ਵੀ ਸਾਡੀ ਜ਼ਿੰਦਗੀ ਦੇ ਵਿੱਚ ਰੋਜ਼ਮੱਰਾ ਦੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਹੈ ਬੀਮਾ ਹੋਣਾ ਹਰੇਕ ਬੰਦੇ ਦੇ ਲਈ ਔਰ ਹਰੇਕ ਪਰਿਵਾਰ ਦੇ ਮੈਂਬਰ ਲਈ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਕੋਈ ਪਤਾ ਨਹੀਂ ਕਿਸ ਵੇਲੇ ਕਿਸ ਬੰਦੇ 'ਤੇ ਕੀ ਆਫਤ ਜਾਂ ਕੀ ਘਟਨਾ ਆ ਜਾਣੀ ਜਾਂ ਘਟਨਾ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਇਹਨਾਂ ਘਟਨਾਵਾਂ ਨੂੰ ਅਤੇ ਘਟਨਾਵਾਂ ਅਤੇ ਆਪਣੇ ਫੈ ਕਿਸੇ ਤਰੀਕੇ ਦੇ ਵਿੱਤੀ ਲੋਸ ਵਿੱਤੀ ਘਾਟੇ ਤੋਂ ਬਚਣ ਲਈ ਸਾਨੂੰ ਬੀਮਾ ਕੰਪਨੀਆਂ ਜਿਹੜੀਆਂ ਉਹ ਸਹਾਇਤਾ ਪ੍ਰਦਾਨ ਕਰਦੀਆਂ ਉਹਦੇ ਲਈ ਸਾਨੂੰ ਇਹਨਾਂ ਦੇ ਜੋ ਰੂਲ ਹੈਗੇ ਆ ਉਹ ਮੰਨਣਯੋਗ ਹੁੰਦੇ ਆ ਜਿਵੇਂ ਇਹਨਾਂ ਦੀਆਂ ਜੋ ਕਿਸਤਾਂ ਸਮੇਂ ਸਮੇਂ 'ਤੇ ਸ ਸਬਮਿਟ ਕਰਾਉਣੀਆਂ ਕਿਸ਼ਤਾਂ ਸ ਵਗੈਰਾ ਸਮੇਂ ਸਮੇਂ 'ਤੇ ਸਬਮਿਟ ਕਰਾਉਣੀ ਆ ਜਿਹਦੇ ਜਿਹਦੇ ਨਾਲ ਹੀ ਇਹ ਕੰ ਬੀਮਾ ਕੰਪਨੀਆਂ ਜਿਹੜੀਆਂ ਹੈਗੀਆਂ ਜੋ ਸਾਡੇ ਨਾਲ ਖੜ੍ਹਦੀਆਂ ਕਿਉਂਕਿ ਅਸੀਂ ਇਹਨਾਂ ਦੀਆਂ ਸ਼ਰਤਾਂ ਨੂੰ ਮੰਨਦੇ ਹੋਏ ਇਹਨਾਂ ਦੀ ਕਿਸ਼ਤਾਂ ਵਗੈਰਾ ਸਮੇਂ ਸਮੇਂ 'ਤੇ ਜਮਾਂ ਕਰਵਾ ਰਹੇ ਹਾਂ ਔਰ ਜਦੋਂ ਕੋਈ ਘਟਨਾ ਸਾਡੇ ਨਾਲ ਵਾਪਰਦੀ ਹੈ ਤਾਂ ਉਹਦੇ ਸੰਬੰਧ ਵਿੱਚ ਸਾਨੂੰ ਇਹ ਜਿਹੜਾ ਸਾਡਾ ਵਿੱਤੀ ਕੋਈ ਲੋਸ ਹੁੰਦਾ ਤਾਂ ਉਹਦੇ ਵਿੱਚ ਪੂਰਤੀ ਕਰਾਉਂਦੇ ਆ